ਬਗੀਚਾ ਬਣਾਉਣ ਵਾਸਤੇ ਸਾਡਾ ਅਨੁਭਵ ਬਹੁਤ ਸੀ ਵੀ ਅਸੀਂ ਉਸਨੂੰ ਬਹੁਤ ਹੀ ਸੁਝਾਅ ਦਿੱਤੇ ਉਸਨੂੰ ਪਹਿਲਾਂ ਅਸੀਂ ਆਪਣੇ ਆਕਸੀਜਨ ਪਲਾਂਟਸ ਦੱਸੇ ਫਿਰ ਅਸੀਂ ਉਹਨੂੰ ਸੋਹਣੇ ਸੋਹਣੇ ਫੁੱਲ ਦੱਸੇ ਜਿੱਦਾਂ ਕੱਟ ਉਹਨਾਂ ਦੇ ਹਰੇਕ ਚੀਜ਼ ਬਾਰੇ ਅਸੀਂ ਉਹਨਾਂ ਨੂੰ ਦੱਸਿਆ ਪਾਰਕ ਦੇ ਵਿੱਚ ਮਿੱਟੀ ਪਵਾਈ ਫਿਰ ਉਹਨਾਂ ਨੂੰ ਉਹਨਾਂ ਨੂੰ ਜਿੱਦਾਂ ਵੀ ਕੀਟਨਾਸ਼ਕ ਦਵਾਈਆਂ ਦੱਸੀਆਂ ਫਿਰ ਉਹਨਾਂ ਨੂੰ ਸਪਰੇਅ ਜਿੱਦਾਂ ਵੀ ਕੋਈ ਕੀੜਾ ਕੋਈ ਉਹਨਾਂ ਨੂੰ ਜਿਹੜੇ ਬੂਟੇ ਉਹ ਖ਼ਰਾਬ ਨਾ ਹੋਣ ਅਤੇ ਉਹਨਾਂ ਨੂੰ ਮੌਸਮੀ ਜਿੱਦਾਂ ਵੀ ਕੋਈ ਜਿੱਦਾਂ ਮੌਸਮ ਦੇ ਹਿਸਾਬ ਨਾਲ ਕੋਈ ਵੀ ਜਿੱਦਾਂ ਜਿਹੜੀ ਵੀ ਦਵਾਈ ਪਾਉਣੀ ਆ ਉਹ ਬਾਰੇ ਦੱਸਿਆ ਵੀ ਕਿੱਦਾ ਕਿੱਦਾਂ ਇਹਨਾਂ ਦਾ ਇਹਨਾਂ ਦੀ ਸੇਫਟੀ ਰੱਖਣੀ ਆ ਫਿਰ ਉਹਨਾਂ ਨੂੰ ਦੱਸਿਆ ਵੀ ਤੁਸੀਂ ਕਿੰਨੇ ਟਾਈਮ ਬਾਅਦ ਇਹਨਾਂ ਦੀ ਕਟਿੰਗ ਇਹਨਾਂ ਦੀ ਸਾਫ਼ ਸਫਾਈ ਇਹਨਾਂ ਨੂੰ ਇਹਨਾਂ ਦੇ ਘਾਹ ਨੂੰ ਕਿੱਦਾਂ ਕੱਟਣਾ ਵਾਂ ਬੂਟਿਆਂ ਨੂੰ ਕਿੱਦਾਂ ਸੇਫਟੀ ਲੈਣੀ ਆ ਉਹਨਾਂ ਫਿਰ ਮੈਂ ਫੁੱਲਾਂ ਨੂੰ ਇਹ ਕਿਆਰੀ ਬਣਾ ਕੇ ਬਹੁਤ ਸੋਹਣਾ ਹੀ ਵੱਖ ਵੱਖ ਜਗ੍ਹਾ 'ਤੇ ਲਗਾਇਆ ਅਤੇ ਉਨ ਮਤਲਬ ਕਿ ਸਾਡਾ ਪਾਰਕ ਬਣਾਉਣ ਬਗੀਚਾ ਬਣਾਉਣ ਵਿੱਚ ਬਹੁਤ ਹੀ ਅਨੁਭਵ ਸੀ ਸਾਨੂੰ ਬਹੁਤ ਹੀ ਚੰਗਾ ਲੱਗਦਾ ਵੀ ਅਸੀਂ ਉਸਨੂੰ ਆਪਣੇ ਸੁਝਾਅ ਦੱਸੀਏ ਵੀ ਪਾਰਕ ਜਿਹੜੀ ਹੈ ਵੇਖਣ ਨੂੰ ਵੀ ਸੋਹਣੀ ਲੱਗੇ ਅਤੇ ਜਿਸ ਨੇ ਇਹਦਾ ਉਸਨੂੰ ਟਾਈਮ ਟਾਈਮ ਸਿਰ ਉਹਦਾ ਮਤਲਬ ਕਿ ਜੋ ਵੀ ਸੇਫਟੀ ਆ ਉਹ ਕਰਨ ਲਈ ਉਸ ਨੂੰ ਆਖਿਆ ਗਿਆ ਸਾਨੂੰ ਬਹੁਤ ਹੀ ਚੰਗਾ ਲੱਗਾ ਜਦੋਂ ਵੀ ਅਸੀਂ ਇਸ ਕੰਮ ਸੁਝਾਅ ਬਾਰੇ ਸੁਝਾਅ ਜਿਹੜੇ ਉਸ ਬਗੀਚੇ ਵਾਲੇ ਨੂੰ ਦੱਸੇ